ਹੈਲੋ ਮੈਂ ਕੂੜਾ ਇਕੱਠਾ ਕਰਨ ਵਾਲੀ ਸੇਵਾ ਬਾਰੇ ਪੁੱਛਣਾ ਚਾਹੁੰਦਾ ਹਾਂ ਮੇਰਾ ਖਾਤਾ ਨੰਬਰ ਅੱਠ ਚਾਰ ਦੋ ਸੱਤ ਇੱਕ ਦੋ ਤਿੰਨ ਸੱਤ ਇੱਕ ਇੱਕ ਜੀਰੋ ਜੀਰੋ ਜੀਰੋ ਜੀਰੋ ਜੀਰੋ ਜੀਰੋ ਇੱਕ ਅੱਠ ਹੈ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੇਰੀ ਸੇਵਾ ਦੀ ਸਥਿਤੀ ਕਿਵੇਂ ਦੀ ਹੈ ਕੀ ਤੁਸੀਂ ਮੇਰੇ ਖਾਤੇ ਨੂੰ ਅਪਡੇਟ ਕਰਨ ਵਿੱਚ ਮੇਰੀ ਸਹਾਇਤਾ ਕਰ ਸਕਦੇ ਹੋ ਧੰਨਵਾਦ